ਹਾਂਜੀ ਮੈਂ ਕਰਮਪਾਲ ਕੌਰ ਮੈਨੂੰ ਤੁਹਾਡੇ ਨਵੇਂ ਨਵੇਂ ਚ ਰੈਸਟੋਰੈਂਟ ਤੁਹਾਡਾ ਖੁੱਲ੍ਹਿਆ ਆ ਉਹਦੇ ਬਾਰੇ ਪਤਾ ਚੱਲਿਆ ਤਾਂ ਅਸਲ ਵਿੱਚ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਇੱਥੇ ਕਿਹੜੀਆਂ ਕਿਹੜੀਆਂ ਆਈਟਮਾਂ ਜੋ ਖਾਣ ਲਈ ਮਿਲ ਸਕਦੀਆਂ ਹਨ ਜਿੱਦਾਂ ਅਸੀਂ ਕੋਈ ਆਪਣੀ ਪਾਰਟੀ ਕਰਨਾ ਚਾਹੁੰਦੇ ਹਾਂ ਜਿਵੇਂ ਕੋਈ ਬਰਡੇ ਪਾਰਟੀ ਹੋਈ ਜਾਂ ਕੋਈ ਮਤਲਬ ਕੋਈ ਸੈਰੇਮਨੀ ਵਗੈਰਾ ਹੋਈ ਤਾਂ ਉਹ ਜੋ ਸੈਲੀਬਰੇਟ ਕਰਨ ਲਈ ਤੁਹਾਡੀ ਕੀ ਕੀ ਆਈ ਆਈਟਮਾਂ ਨੇ ਜੋ ਜਿਹੜੀਆਂ ਇੱਥੇ ਮਿਲਦੀਆਂ ਹਨ ਜੇ ਮੈਂ ਗੱਲ ਕਰਾਂ ਮਿੱਠੀਆਂ ਆਈਟਮਾਂ 'ਚ ਜਿੱਦਾਂ ਕਿ ਜਲੇਬੀਆਂ ਹੋਈਆਂ ਗੁਲਾਬ ਜਾਮਣਾਂ ਹੋਈਆਂ ਰਸਗੁੱਲੇ ਖੋਏ ਦੀ ਬਰਫੀ ਬੇਸਣ ਦੇ ਲੱਡੂ ਅਤੇ ਜੇ ਆਪਾਂ ਗੱਲ ਕਰੀਏ ਫਾਸਟ ਫੂਡ ਦੀ ਤਾਂ ਫਾਸਟ ਫੂਡ ਵਿੱਚ ਕਿ ਤੁਹਾਡੇ ਪੀਜ਼ਾਂ ਰੈੱਡ ਸੋਸ ਪਾਸਤਾ ਵਾਈਟ ਸੋਸ ਪਾਸਤਾ ਮੈਗੀ ਗ੍ਰਿਲਡ ਸੈਂਡਵਿੱਚ ਗ੍ਰਿਲਡ ਸੈਂਡਵਿੱਚ ਪੀਜ਼ਾ ਮੈਗੀ ਆਮਲੇਟ ਫਰੈਂਚ ਫਰਾਈਜ ਆਦਿ ਮੌਜੂਦ ਹਨ